ਜਦੋਂ ਸਾਡੇ ਘਰ ਕੋਈ ਮਹਿਮਾਨ ਆਉਂਦਾ ਹੈ ਪਹਿਲਾਂ ਤਾਂ ਉਹਨਾਂ ਨੂੰ ਵਧੀਆ ਸਾਫ ਸੁਥਰਾ ਮੰਜੇ ਜਿਵੇਂ ਕੁਰਸੀ ਵਗੈਰਾ 'ਤੇ ਬਿਠਾਇਆ ਜਾਂਦਾ ਹੈ ਫੇਰ ਉਹਨਾਂ ਨੂੰ ਪਾਣੀ ਦਿੱਤਾ ਜਾਂਦਾ ਹੈ ਫੇਰ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਹਨ ਫੇਰ ਉਹਨਾਂ ਦੇ ਖਾਣ ਪੀਣ ਲਈ ਪਹਿਲਾਂ ਤਾਂ ਉਹਨਾਂ ਨੂੰ ਨੈਚੁਰਲ ਜੂਸ ਪਿਆਇਆ ਜਾਂਦਾ ਹੈ ਬਾਅਦ ਵਿੱਚ ਉਹਨਾਂ ਨੂੰ ਚਾਹ ਚਾਹ ਚਾਹ ਦਿੱਤੀ ਜਾਂਦੀ ਹੈ ਜਿਸ ਵਿੱਚ ਬਿਸਕੁਟ ਵਗੈਰਾ ਭੁਜੀਆ ਵਗੈਰਾ ਦਿੱਤਾ ਜਾਂਦਾ ਹੈ ਫੇਰ ਚਾਹ ਪੀਣ ਤੋਂ ਬਾਅਦ ਦੁਪਹਿਰ ਦਾ ਖਾਣਾ ਖਵਾਇਆ ਜਾਂਦਾ ਹੈ ਜਿਸ ਵਿੱਚ ਰੋਟੀ ਚੌਲ ਦਾਲ ਦਹੀਂ ਆਦਿ ਸ਼ਾਮਿਲ ਕੀਤਾ ਜਾਂਦਾ ਹੈ ਦੁਪਹਿਰ ਦੇ ਖਾਣੇ ਤੋਂ ਬਾਅਦ ਰਾਤ ਦਾ ਸਮਾਂ ਆ ਜਾਂਦਾ ਹੈ ਰਾਤ ਦੇ ਸਮੇਂ ਵਿੱਚ ਵੀ ਉਹਨਾਂ ਨੂੰ ਖਾਣਾ ਦਿੱਤਾ ਜਾਂਦਾ ਹੈ ਜਿਸ ਵਿੱਚ ਕੋਈ ਹੋਰ ਸਬਜ਼ੀ ਪਨੀਰ ਚੌਲ ਵਗੈਰਾ ਹੋਰ ਬਹੁਤ ਕੁਝ ਤਿਆਰ ਕੀਤਾ ਜਾਂਦਾ ਹੈ ਰਾਤ ਦੇ ਖਾਣੇ ਤੋਂ ਬਾਅਦ ਉਹਨਾਂ ਨੂੰ ਕੱਪੜੇ ਬਦਲਣ ਲਈ ਕੋਈ ਰੂਮ ਦਿੱਤਾ ਜਾਂਦਾ ਹੈ ਰੂਮ ਦਿੱਤਾ ਜਾਂਦਾ ਹੈ ਬਾਅਦ ਵਿੱਚ ਉਹਨਾਂ ਦੇ ਸੌਣ ਲਈ ਬਿਸਤਰਾ ਤਿਆਰ ਕੀਤਾ ਜਾਂਦਾ ਹੈ ਬਿਸਤਰਾ ਸਾਫ ਸੁਥਰਾ ਅਤੇ ਬਹੁਤ ਵਧੀਆ ਤਰੀਕੇ ਦਾ ਹੋਣਾ ਚਾਹੀਦਾ ਹੈ ਇਸ ਤੋਂ ਬਾਅਦ ਉਹਨਾਂ ਨੂੰ ਰਾਤ ਨੂੰ ਸੌਣ ਵੇਲੇ ਦੁੱਧ ਦਾ ਇੱਕ ਗਲਾਸ ਦੁੱਧ ਦੁੱਧ ਦਿੱਤਾ ਜਾਂਦਾ ਹੈ ਜਿਸ ਨੂੰ ਪੀਣ ਤੋਂ ਬਾਅਦ ਉਹ ਆਪਣਾ ਆਰਾਮ ਕਰਦੇ ਹਨ